ਰੋਪੜ ਸ਼ਹਿਰ ਬਾਰੇ ਦੱਸੋ ਰੋਪੜ ਸ਼ਹਿਰ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ ਸਿੱਧੂ ਘਾਟੀ ਦੀ ਸੱਭਿਅਤਾ ਪੁਰਾਤਨ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਇੱਥੇ ਇੱਕ ਅਜਾਇਬ ਘਰ ਵੀ ਹੈ ਜਿਸ ਵਿੱਚ ਇਤਿਹਾਸਿਕ ਚੀਜ਼ਾਂ ਨੂੰ ਵੀ ਦੇਖਣ ਨੂੰ ਮਿਲਦੀਆਂ ਹਨ ਰੂਪਨਗਰ ਸ਼ਹਿਰ ਹੈੱਡਵਰਕਰਸ ਦੇ ਸਤਲੁਜ ਦਰਿਆ ਦੇ ਕਿਨਾਰੇ 'ਤੇ ਹੈ ਇੱਥੇ ਵੇਰਕਾ ਪਲਾਂਟ ਵੀ ਹੈ ਜਿੱਥੇ ਸ਼ਾਮ ਨੂੰ ਬੱਚੇ ਸਾਰੇ ਘੁੰਮਣ ਫਿਰਨ ਵੀ ਆਉਂਦੇ ਹਨ ਅਤੇ ਨਾਲ ਉਹਨਾਂ ਨੂੰ ਖਾਣ ਪੀਣ ਦੀਆਂ ਆਇਸਕਰੀਮ ਵਗੈਰਾ ਸਾਰਾ ਕੁਛ ਦੁੱਧ ਲੱਸੀ ਖੀਰ ਸਭ ਵੇਰਕਾ ਤੋਂ ਬਣਿਆ ਸਮਾਨ ਮਿਲਦਾ ਹੈ ਉਸ ਤੋਂ ਬਾਅਦ ਗੁਰਦੁਆਰਾ ਅੱਗੇ ਗੁਰਦੁਆਰਾ ਹੈ ਅਤੇ ਉਸ ਦੇ ਨਾਲ ਉੱਥੇ ਜਾ ਕੇ ਸਾਰੇ ਲੋਕ ਨਮਸਕਾਰ ਕਰਨ ਜਾਂਦੇ ਨੇ ਘੁੰਮਣ ਫਿਰਨ ਵੀ ਆਉਂਦੇ ਨੇ ਅਤੇ ਨਾਲ ਨਮਸਕਾਰ ਵੀ ਕਰਦੇ ਨੇ ਰੋਪੜ ਸ਼ਹਿਰ ਦੇ ਵਿੱਚ ਬਹੁਤ ਸਾਰਾ ਸਮਾਨ ਬਹੁਤ ਅੱਛਾ ਮਿਲਦਾ ਹੈ ਕੱਪੜੇ ਵੀ ਸਾਨੂੰ ਬਹੁਤ ਅੱਛੇ ਮਿਲਦੇ ਨੇ ਦੁਕਾਨਾਂ ਬਹੁਤ ਸਾ ਸਾ ਸਾਰੀਆਂ ਦੁਕਾਨਾਂ ਬਹੁਤ ਅੱਛੀਆਂ ਬਣੀਆਂ ਹੋਈਆਂ ਹੈ ਜਿਸ ਵਿੱਚ ਸਾਨੂੰ ਸਾਰਾ ਸਮਾਨ ਹਰ ਇੱਕ ਚੀਜ਼ ਮਿਲਦੀ ਹੈ